ਖੇਡਾਂ ਲੋਕਾਂ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਵਿੱਚ ਬਹੁਤ ਹੀ ਯੋਗਦਾਨ ਪਾਉਂਦਾ ਹੈ ਜਿਵੇਂ ਕਿ ਅਗਰ ਕੋਈ ਬਹੁਤ ਹੀ ਨਿਰਾਸ਼ ਹੈ ਬਹੁਤ ਹੀ ਦੁਖੀ ਹੈ ਅਤੇ ਉਹ ਆਪਣੇ ਆਉਣ ਵਾਲਾ ਜੋ ਉਹਨੂੰ ਕੰਮ ਦਿੱਤਾ ਜਾਵੇਗਾ ਅਗਰ ਉਹ ਜੋਬ ਕਰਦਾ ਹੈ ਉਹ ਨਿਰਾਸ਼ ਦੁਖੀ ਹੈ ਅਤੇ ਉਹਨੂੰ ਜਿਹੜਾ ਕੰਮ ਦਿੱਤਾ ਜਾਵੇਗਾ ਉਹ ਉਹਨੂੰ ਬਹੁਤ ਹੀ ਅਗਰ ਉਹ ਲੈ ਵੀ ਲਵੇਗਾ ਉਹ ਪਹਿਲਾਂ ਤਾਂ ਉਹ ਨਾਂਹ ਹੀ ਕਰੇਗਾ ਉਸ ਕੰਮ ਨੂੰ ਅਗਰ ਉਹ ਲੈ ਵੀ ਲਵੇਗਾ ਉਸ ਕੰਮ ਨੂੰ ਜਿਵੇਂ ਜ਼ਬਰਦਸਤੀ ਕੋਈ ਵੱਡੇ ਬੰਦੇ ਨੇ ਉਹਨੂੰ ਕੰਮ ਦੇ ਦਿੱਤਾ ਕਿ ਉਹਨੂੰ ਕਰਨਾ ਹੀ ਪੈਣਾ ਤਾਂ ਉਸ ਕੰਮ ਦੀ ਜਿਹੜੀ ਕੁਆਲਿਟੀ ਹੋਏਗੀ ਉਹ ਬਹੁਤ ਹੀ ਖਰਾਬ ਹੋਏਗੀ ਉਹ ਤੋਂ ਕੰਪਲੀਟ ਵੀ ਨਹੀਂ ਹੋਏਗਾ ਅਤੇ ਇਸ ਤੋਂ ਬਚਣ ਦੇ ਲਈ ਲੋਕ ਜ਼ਿਆਦਾਤਰ ਕੀ ਕਰਦੇ ਹਨ ਉਹ ਗੇਮਾਂ ਖੇਡਦੇ ਹਨ ਉਹ ਆਪਣੇ ਸਰੀਰ ਦੀ ਸਰੀਰਾਂ ਨੂੰ ਫਿਟ ਕਰਦੇ ਹਨ ਜਿਵੇਂ ਕਿ ਅਗਰ ਮੈਂ ਤੁਹਾਨੂੰ ਇੱਕ ਉਦਾਹਰਨ ਦੇਵਾਂ ਅਗਰ ਮੰਨ ਲਉ ਇੱਕ ਆਦਮੀ ਹੈ ਜੋ ਕਿ ਆਪਣੇ ਦੋਸਤਾਂ ਨਾਲ ਹਰ ਹਫਤੇ ਇੱਕ ਦਿਨ ਖੇਡਣ ਜਾਂਦਾ ਫੁੱਟਬੋਲ ਖੇਡਣ ਜਾਂਦਾ ਹੈ ਤਾਂ ਉਹ ਕੀ ਹੋਏਗਾ ਉਸ ਇੱਕ ਦਿਨ ਵਿੱਚ ਉਹ ਆਪਣੇ ਦੋਸਤਾਂ ਨਾਲ ਮਿਲੇਗਾ ਆਪਣੇ ਦੋਸਤਾਂ ਨਾਲ ਖੇਡੇਗਾ ਉਹਨੂੰ ਆਪਣਾ ਸਾਰਾ ਕੁਛ ਯਾਦ ਆਵੇਗਾ ਕਿ ਹਾਂ ਆਪਣੇ ਦੋਸਤਾਂ ਨੇ ਕਿਵੇਂ ਸਮੇਂ ਬਿਤਾਏ ਉਹਦੇ ਨਾਲ ਉਹ ਖੁਸ਼ ਹੋ ਜਾਵੇਗਾ ਉਹਦੇ ਨਾਲ ਉਹ ਅੰਦਰੋਂ ਖੁਸ਼ ਹੋਏਗਾ ਉਹਦੇ ਮੂੰਹ 'ਤੇ ਪੂਰੇ ਹਫਤਾ ਸਮਾਈਲ ਰਹੇਗੀ ਉਹ ਕੰਮ ਕਰਨ ਲਈ ਬਹੁਤ ਹੀ ਅਟੈਟ ਅਟੈਂਟਿਵ ਰਹੇਗਾ ਹਾਲਾਂਕਿ ਬਹੁਤ ਧਿਆਨ ਰੱਖੇਗਾ ਉਹ ਆਪਣਾ ਕੰਮ ਕਰਨ ਲਈ ਅਤੇ ਇਹ ਸਭ ਕੁਛ ਉਹਨੂੰ ਖੇਡਾਂ ਦੇ ਕਰਕੇ ਹੀ ਹੋ ਰਿਹਾ ਕਿਉਂਕਿ ਉਹ ਇੱਕ ਇੱਕ ਦਿਨ ਸਿਰਫ ਇੱਕ ਦਿਨ ਆਪਣੇ ਦੋਸਤਾਂ ਦਾ ਖੇਡਦਾ ਪਿਆ ਹੈ ਇਸ ਕਰਕੇ ਉਹਨੂੰ ਅਗਰ ਮੰਨ ਲਉ ਚਲੋ ਛੱਡੋ ਇਹ ਗੱਲ ਅਗਰ ਮੰਨ ਲਉ ਕੋਈ ਇਕੱਲਾ ਬੰਦਾ ਹੁਣ ਉਹਦੇ ਕੋਈ ਦੋਸਤ ਨਹੀਂ ਹੈਗੇ ਕੋਲਜ ਕੋਈ ਇੱਦਾਂ ਦਾ ਗਿਆ ਜਾਂ ਕੋਈ ਇੱਦਾਂ ਦੀ ਘਟਨਾ ਹੋ ਗਈ ਕਿ ਉਹਦੇ ਕੋਲ ਦੋਸਤ ਨਹੀਂ ਬਣ ਪਾਏ ਜਾਂ ਬਹੁਤ ਦੂਰ ਦੇ ਹੈਗਾ ਉਹਦੇ ਦੋਸਤ ਉਹਦੇ ਨਾਲ ਖੇਡਣ ਨਹੀਂ ਆ ਸਕਦੇ ਉਸ ਹਾਲਤ ਵਿੱਚ ਉਹ ਆਹ ਕਿਸੀ ਇੱਕ ਕਲੱਬ ਨੂੰ ਜੁਆਇਨ ਕਰ ਸਕਦਾ ਹੈ ਲਾਈਕ ਅਗਰ ਉਹ ਕਿਸੇ ਕਲੱਬ ਨੂੰ ਜੁਆਇਨ ਕਰ ਲੈਂਦਾ ਹੈ ਕਿਉਂਕਿ ਕਲੱਬ ਵਿੱਚ ਦੋ ਟਾਈਮ ਟਰੇਨਿੰਗ ਹੁੰਦੀ ਹੈ ਇੱਕ ਸਵੇਰੇ ਅਤੇ ਇੱਕ ਸ਼ਾਮੀ ਸ਼ਾਮੀ ਤਾਂ ਉਹ ਆਪਣੇ ਕੰਮ 'ਤੇ ਹੋਏਗਾ ਇਸ ਕਰਕੇ ਉਹ ਸਵੇਰੇ ਆ ਸਕਦਾ ਹੈ ਕਲੱਬ ਵਿੱਚ ਹੁਣ ਕਲੱਬ ਵਿੱਚ ਜਾਣ ਦਾ ਫਾਇਦਾ ਕੀ ਹੈ ਪਹਿਲਾ ਤਾਂ ਉਹਦੀ ਖੁਰਾਕ ਵਧੀਆ ਹੋ ਜਾਵੇਗੀ ਕਲੱਬ ਵਿੱਚ ਸਭ ਉਹਨੂੰ ਦੱਸਣਗੇ ਜਿੰਨੇ ਵੀ ਲੋਕ ਹੋਊਗੇ ਸਭ ਉਹ ਤੋਂ ਪੁਰਾਣੇ ਹੋਊਗੇ ਸਭ ਉਹਨਾਂ ਨੂੰ ਦੱਸੂਗੇ ਕਿ ਤੇਰੇ ਲਈ ਆਹ ਵਧੀਆ ਹੈ ਆਹ ਵਧੀਆ ਨਹੀਂ ਹੈ ਅਤੇ ਕਲੱਬ ਵਿੱਚ ਇੰਨੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਆਪਣਾ ਗਮ ਉੱਦਾਂ ਹੀ ਭੁੱਲ ਜਾਂਦੇ ਹੋ ਜਿਵੇਂ ਕਿ ਅਗਰ ਤੁਸੀਂ ਫੁੱਟਬੋਲ ਦੇ ਕੋਈ ਕਲੱਬ ਜੁਆਇਨ ਕਰਦੇ ਹੋ ਤੁਸੀਂ ਉੱਥੇ ਪ੍ਰੈਕਟਿਸ ਕਰਦੇ ਹੋ ਸਵੇਰੇ ਸਵੇਰੇ ਸਵੇਰੇ ਉੱਠ ਕੇ ਪ੍ਰੈਕਟਿਸ ਕਰਦੇ ਹੋ ਮਨ ਤਾਜ਼ਾ ਹੋ ਜਾਂਦਾ ਉਹ ਤੋਂ ਬਾਅਦ ਤੁਸੀਂ ਵਧੀਆ ਖੁਰਾਕ ਲੈਣੀ ਅਤੇ ਤੁਹਾਡੇ ਨਵੇਂ ਦੋਸਤ ਬਣ ਜਾਊਗੇ ਜਿੰਨੇ ਵੀ ਕਲੱਬ ਵਾਲੇ ਹੋਊਗੇ ਸਭ ਨਵੇਂ ਦੋਸਤ ਬਣ ਜੂਗੇ ਤੁਸੀਂ ਉੱਦਾਂ ਖੁਸ਼ ਰਹਿਣਾ ਸ਼ੁਰੂ ਕਰ ਦੋਗੇ ਅਤੇ ਇਹ ਸਭ ਤਰ੍ਹਾਂ ਤੁਹਾਨੂੰ ਮਦਦ ਕਰੂਗੇ ਇਹ ਸਭ ਲੋਕ ਤੁਹਾਨੂੰ ਮਦਦ ਕਰੂੰਗੇ ਤੁਹਾਡੀ ਦੁਖੀ ਲਾਈਫ ਤੋਂ ਬਾਹਰ ਆਉਣ ਲਈ ਅਤੇ ਖੁਸ਼ੀਆਂ ਵਿੱਚ ਭਰਨ ਦੇ ਲਈ ਅਤੇ ਇਸ ਕਰਕੇ ਹੀ ਜੋ ਖੇਡਾਂ ਹੈਗੀਆਂ ਉਹ ਤੁਹਾਡੇ ਮਾਨਸਿਕ ਅਤੇ ਸਰੀਰਿਕ ਤਰ੍ਹਾਂ ਤੁਹਾਨੂੰ ਫਿਟ ਕਰ ਦਿੰਦੀਆਂ ਹੈ ਧੰਨਵਾਦ